ਊਧਮ ਸਿੰਘ ਦੇ ਜਨਮ ਦਾ ਨਾਮ ਸ਼ੇਰ ਸਿੰਘ ਸੀ ਊਧਮ ਸਿੰਘ ਦਾ ਜਨਮ ਛੱਬੀ ਦਸੰਬਰ ਅਠਾਰਾਂ ਸੌ ਨੜਿਨਵੇਂ ਈਸਵੀ ਨੂੰ ਹੋਇਆ ਉਹ ਗਦਰ ਪਾਰਟੀ ਅਤੇ ਐਚ ਐਸ ਆਰ ਏ ਨਾਲ ਸੰਬੰਧਿਤ ਇੱਕ ਭਾਰਤੀ ਕ੍ਰਾਂਤੀਕਾਰੀ ਸਨ ਜੋ ਕਿ ਤੇਰਾਂ ਮਾਰਚ ਉੱਨੀ ਸੌ ਚਾਲੀ ਨੂੰ ਭਾਰਤ ਵਿੱਚ ਪੰਜਾਬ ਦੇ ਸਾਬਕਾ ਲੈਫਟੀਨੈਂਟ ਗਵਰਨਰ ਮਾਈਕਲ ਉਡਵਾਇਰ ਦੀ ਹੱਤਿਆ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਚਿਹਰਾ ਹੈ ਇਹ ਕਤਲ ਉੱਨੀ ਸੌ ਉੱਨੀ ਵਿੱਚ ਅੰਮ੍ਰਿਤਸਰ ਵਿੱਚ ਜਲਿਆਂਵਾਲਾ ਬਾਗ ਦੇ ਸਾਕੇ ਦਾ ਬਦਲਾ ਲੈਣ ਲਈ ਕੀਤਾ ਗਿਆ ਸੀ ਊਧਮ ਸਿੰਘ ਤੋਂ ਬਾਅਦ ਵਿੱਚ ਕਤਲ ਦਾ ਮੁਕੱਦਮਾ ਚਲਾਇਆ ਗਿਆ ਅਤੇ ਦੋਸ਼ੀ ਠਹਿਰਾਇਆ ਗਿਆ ਕੱਤੀ ਜੁਲਾਈ ਉੱਨੀ ਸੌ ਚਾਲੀ ਨੂੰ ਊਧਮ ਸਿੰਘ ਨੂੰ ਫਾਂਸੀ ਦਿੱਤੀ ਗਈ ਹਿਰਾਸਤ ਵਿੱਚ ਰਹਿਣ ਦੌਰਾਨ ਉਸਨੇ ਰਾਮ ਮੁਹੰਮਦ ਸਿੰਘ ਆਜ਼ਾਦ ਨਾਮ ਦੀ ਵਰਤੋਂ ਕੀਤੀ ਜੋ ਭਾਰਤ ਵਿੱਚ ਧਰਮ ਨਿਰਪੱਖ ਅਤੇ ਉਸਦੀ ਬਸਤੀਵਾਦੀ ਵਿਰੋਧੀ ਭਾਵਨਾ ਨੂੰ ਦਰਸਾਉਂਦਾ ਹੈ ਊਧਮ ਸਿੰਘ ਦਾ ਮੌਤ ਦਾ ਕਾਰਨ ਉਸਦੀ ਫਾਂਸੀ ਸੀ ਊਧਮ ਸਿੰਘ ਦੀ ਮੌਤ ਕੱਤੀ ਜੁਲਾਈ ਉੱਨੀ ਸੌ ਚਾਲੀ ਨੂੰ ਪੈਂਟਨ ਵਿਲੇ ਜੇਲ ਦੇ ਵਿੱਚ ਹੋਈ ਸੀ ਜੋ ਕਿ ਲੰਡਨ ਇੰਗਲੈਂਡ ਦੇ ਵਿੱਚ ਹੈ ਊਧਮ ਸਿੰਘ ਨੂੰ ਰਾਮ ਮੁਹੰਮਦ ਸਿੰਘ ਆਜ਼ਾਦ ਉਦੇ ਸਿੰਘ ਇਹਨਾਂ ਨਾਵਾਂ ਦੇ ਨਾਲ ਵੀ ਜਾਣਿਆ ਜਾਂਦਾ ਹੈ ਊਧਮ ਸਿੰਘ ਪ੍ਰਸਿੱਧ ਕ੍ਰਾਂਤੀਕਾਰੀ ਸੀ ਊਧਮ ਸਿੰਘ ਦਾ ਸਬੰਧ ਗਦਰ ਪਾਰਟੀ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਇੰਡੀਅਨ ਵਰਕਰਜ ਐਸੋਸੀਏਸ਼ਨ ਦੇ ਨਾਲ ਰਿਹਾ ਹੈ ਉਹ ਜਲਿਆਂ ਵਾਲੇ ਸਾਕੇ ਦੇ ਬਦਲਾ ਲੈਣ ਲਈ ਮਾਈਕਲੋਅਡਵਾਰ ਦੀ ਉਸਨੇ ਹੱਤਿਆ ਕੀਤੀ ਇਸ ਲਈ ਉਹ ਬਹੁਤ ਪ੍ਰਸਿੱਧ ਹੈ ਭਾਰਤੀ ਆਜ਼ਾਦੀ ਦੀ ਲਹਿਰ ਨਾਲ ਊਧਮ ਸਿੰਘ ਸੰਬੰਧਿਤ ਸੀ ਊਧਮ ਸਿੰਘ ਭਾਰਤੀ ਸੁਤੰਤਰਤਾ ਅੰਦੋਲਨ ਦੀ ਇੱਕ ਜਾਣੀ ਪਛਾਣੀ ਹਸਤੀ ਹੈ ਉਸਨੂੰ ਸ਼ਹੀਦ ਏ ਆਜ਼ਮ ਸਰਦਾਰ ਊਧਮ ਸਿੰਘ ਵੱਜੋਂ ਜਾਣਿਆ ਜਾਂਦਾ ਹੈ ਸ਼ਹੀਦ ਏ ਆਜ਼ਮ ਦਾ ਅਰਥ ਮਹਾਨ ਸ਼ਹੀਦ ਹੁੰਦਾ ਹੈ